ਹੈਲੋ ਤੁਸੀਂ ਬਜਰੰਗੀ ਨਰਸਰੀ ਤੋਂ ਬੋਲ ਰਹੇ ਅਸੀਂ ਗਮਲੇ ਲੈਣੇ ਸੀ ਫੁੱਲਾਂ ਦੇ ਬੂਟੇ ਲੈਣੇ ਸੀ ਅਸੀਂ ਫਲਾਵਰਸ ਦੇ ਅਸੀਂ ਅਸੀਂ ਕਮਰੇ 'ਚ ਲਾਉਣ ਵਾਸਤੇ ਲੈਣੇ ਆ ਅਤੇ ਕੁਝ ਬਾਹਰ ਲਾਉਣ ਵਾਸਤੇ ਲੈਣੇ ਆ ਮੌਸਮ ਗਰਮੀ ਕਰਕੇ ਹਾਂਜੀ ਹਾਂਜੀ ਅੱਛਾ ਠੀਕ ਹੈ ਅਸੀਂ ਗਮਲੇ ਵੀ ਲੈਣੇ ਹੈ ਅਸੀਂ ਮਿੱਟੀ ਦੇ ਗਮਲੇ ਲੈਣੇ ਹੈ ਉਹ ਤੁਹਾਨੂੰ ਦ ਦੱਸ ਦੇਵਾਂਗੇ ਕਿੰਨੇ ਲਵਾਂਗੇ ਅਸੀਂ ਦ ਦਸ ਤੱਕ ਤਾਂ ਲੈ ਲਵਾਂਗੇ ਅਸੀਂ ਅਤੇ ਅਸੀਂ ਸਟੈਂਡ ਵੀ ਲੈਣੇ ਆ ਗਮਲੇ ਵਾਸਤੇ ਹਾਂਜੀ ਠੀਕ ਹੈ ਜੀ ਸਾਨੂੰ ਕੋਈ ਵਧੀਆ ਡਿਜ਼ਾਇਨਜ ਦਿਖਾ ਦਿਉ ਜਿਹੜੇ ਵਧੀਆ ਲੱਗਣ